ਭਾਰਤ ਅੱਜ ਦੇ ਟਾਈਮ ਦਾ ਸਭ ਤੋਂ ਉਧਮੀ ਅਤੇ ਉਭਰਦੇ ਯੁਗ ਦਾ ਆਨੰਦ ਮਾਨਣ ਲਈ ਸਭ ਤੋਂ ਅੱਛਾ ਦੇਸ਼ ਬਣ ਰਿਹਾ ਬਹੁਤ ਚੀਜ਼ਾਂ ਜੋ ਨਵੀਆਂ ਭਾਰਤ 'ਚ ਮੇਕ ਇਨ ਇੰਡੀਆ ਦੇ ਨਾਂ 'ਤੇ ਬਣ ਰਹੀਆਂ ਨੇ ਪਹਿਲੇ ਲੋਗ ਬਾਹਰੋਂ ਚੀਜ਼ਾਂ ਮੰਗਵਾ ਕੇ ਅਤੇ ਆਪਣੇ ਦੇਸ਼ ਵਿੱਚ ਭਾਰਤ ਵਿੱਚ ਉਹਨਾਂ ਨੂੰ ਸੇਲ ਪਰਚੇਜ਼ ਦਾ ਕੰਮ ਕਰਦਾ ਸੀ ਹੁਣ ਉਹ ਖੁਦ ਬਣਾ ਰਹੇ ਨੇ ਅਤੇ ਖੁਦ ਉਸ ਨੂੰ ਵੇਚ ਰਹੇ ਨੇ ਜਿਹਦੇ ਨਾਲ ਕਿ ਭਾਰਤ ਦੀ ਇਕਨੋਮੀ ਵੀ ਅੱਛੀ ਜਾ ਰਹੀ ਹੈ ਅਤੇ ਬਹੁਤ ਲੋਕ ਵੀ ਲੋਕਾਂ ਨੂੰ ਕੰਮ ਮਿਲ ਰਿਹਾ ਜਿਹਦੇ 'ਚ ਬੇਰੋਜ਼ਗਾਰੀ ਵੀ ਘੱਟ ਰਹੀ ਹੈ ਅਤੇ ਹੌਲੀ ਹੌਲੀ ਲੋਕ ਨਵੇਂ ਨਵੇਂ ਕਾਰੋਬਾਰ ਲੱਭ ਕੇ ਆਪਣਾ ਕੰਮ ਸਰਕਾਰ ਦੇ ਨਾਲ ਕਰ ਰਹੀ ਹੈ ਨਵੀਆਂ ਨਵੀਆਂ ਚੀਜ਼ਾਂ ਜਿਹਨਾਂ ਨਾਲ ਲੋਕਾਂ ਨੇ ਲੋਕ ਜੁੜ ਰਹੇ ਨੇ ਅਤੇ ਨਵੇਂ ਕੰਮ ਕਰ ਰਹੇ ਨੇ ਅਤੇ ਇਹਨਾਂ ਨਾਲ ਲੋਕਾਂ ਨੂੰ ਕਾਰੋਬਾਰ ਬਹੁਤ ਮਿਲ ਰਿਹਾ ਜਿਹੜਾ ਕਿ ਭਾਰਤ ਵਾਸਤੇ ਬਹੁਤ ਅੱਛਾ ਹੈ ਅਤੇ ਮੈਂ ਇਹਨਾਂ ਦੇ ਨਾਲ ਜੁੜ ਕੇ ਮੈਂ ਵੀ ਕੰਮ ਕਰਨਾ ਪਸੰਦ ਕਰਾਂਗੀ ਥੈਂਕ ਯੂ